ਖੇਡਾਂ ਦੇ ਨਾਲ ਪਹਿਲਾ ਵੱਡਾ ਜਿਹੜਾ ਆ ਫ਼ਾਇਦਾ ਆ ਵੀ ਲਾਭ ਆ ਜਿਹੜਾ ਇਹਦਾ ਉਹ ਜੀ ਪਿੰਡ ਦੇ ਜਿਹੜੇ ਲੋਕ ਆ ਵਾਧੂ ਘਾਟੂ ਲੜਾਈ ਝਗੜਿਆਂ ਅਤੇ ਨਸ਼ਿਆਂ ਤੋਂ ਬਚੇ ਰਹਿੰਦੇ ਆ ਅਤੇ ਇੱਕ ਤਾਂ ਖੇਡਾਂ ਦੇ ਨਾਲ ਪਿੰਡ ਦਾ ਜਿਹੜਾ ਨਾਂ ਆ ਉੱਚਾ ਹੁੰਦਾ ਅਤੇ ਉ ਉਤਲੇ ਲੈਵਲ ਤੱਕ 'ਚ ਜਾਂਦੇ ਆ ਉੱਤੋਂ ਤੱਕ ਜਾਂਦੇ ਆ ਜਿਹੜਾ ਕਿ ਪਿੰਡਾਂ ਦੀ ਜਿਹੜੀ ਪਹਿਚਾਣ ਆ ਉਹ ਵੱਧਦੀ ਆ ਖੇਡਾਂ ਦੇ ਨਾਲ ਅਤੇ ਜਦੋਂ ਖੇਡਾਂ ਚੱਲਦੀਆਂ ਤਾਂ ਉੱਦਾਂ ਦਾ ਲੋਕਾਂ ਦਾ ਆਪਸ ਦੇ ਵਿੱਚ ਜਿਵੇਂ ਖੇਡਾਂ ਦੇ ਨਾਲ ਇੱਕ ਭਾਈਚਾਰਾ ਵੱਧ ਜਾਂਦਾ ਹੈ ਇੱਕ ਅਤੇ ਇਹਨਾਂ ਦੀ ਆਪਸੀ ਗੱਲਬਾਤ ਹੁੰਦੀ ਆ ਜਿਵੇਂ ਅਤੇ ਇਹਨਾਂ ਦੇ ਭਾਈਚਾਰਾ ਵੱਧਦਾ ਭਾਈਚਾਰਕ ਵਧਣ ਦੇ ਨਾਲ ਇਹਨਾਂ ਦੇ ਵਿੱਚ ਮਤਲਬ ਕੋਈ ਕੁੜੱਤਣ ਮਨਾਂ ਦੀ ਨਿਕਲਦੀ ਰਹਿੰਦੀ ਆ ਅਤੇ ਉਹਦੇ ਵਿੱਚ ਜਿਹੜਾ ਕਿ ਹਰ ਇੱਕ ਨੂੰ ਖੇਡਾਂ ਦਾ ਫਾਇਦਾ ਹੀ ਹੈ ਉਹਦੇ ਨਾਲ ਬੰਦਾ ਆਰਥਿਕ ਤੌਰ 'ਤੇ ਵੀ ਉੱਚਾ ਹੋ ਜਾਂਦਾ ਸਮਾਜਿਕ 'ਚ ਵੀ ਹੁੰਦਾ ਹੀ ਹੁੰਦਾ ਨਾਲ ਬੰਦਾ ਸਮਾਜਿਕ 'ਚ ਵੀ ਉੱਚਾ ਹੁੰਦਾ ਅਤੇ ਪਿੰਡਾਂ ਤੋਂ ਪਿੰਡਾਂ ਦੀ ਪਹਿਚਾਣ ਵੱਧਦੀ ਆ ਅਤੇ ਲੋਕ ਜਿਵੇਂ ਇੱਕ ਤੋਂ ਦੂਜੇ ਪਿੰਡ ਦੇ ਵਿੱਚ ਖੇਡਣ ਜਾਂਦੇ ਤਾਂ ਇੱਕ ਤੋਂ ਦੂਜੀ ਥਾਂ 'ਤੇ ਜਾ ਕੇ ਉਹਨਾਂ ਨਾਲ ਜਿਹੜੀ ਆਪਸੀ ਗੱਲਬਾਤ ਹੁੰਦੀ ਹੈ ਅਤੇ ਅੱਗੋਂ ਵਾਸਤੇ ਜਿਹੜੀ ਉਹਨਾਂ ਦਾ ਸਾਂਝ ਅਗਾਂਹ ਦੀ ਅੱਗੇ ਦੀ ਅੱਗੇ ਵੱਧਦੀ ਹੈ